ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੀਦੀ ਜੀ ਹਾਂਜੀ ਬਾਬਾ ਜੀ ਉਹ ਮੈਂ ਇਹ ਪੁੱਛਣਾ ਸੀ ਕਿ ਗੁਰਦੁਆਰੇ ਟਾਹਲੀ ਸਾਹਿਬ ਵੀ ਮਤਲਬ ਕਿ ਇਤਿਹਾਸ ਬਾਰੇ ਮੈਂ ਜਾਣਨਾ ਚਾਹੁੰਦੀ ਸੀ ਕੀ ਇਤਿਹਾਸ ਜੀ ਜੀ ਜੇ ਮੈਂ ਆਵਾਂ ਮਤਲਬ ਕਿ ਆਉਣਾ ਹੋਵੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਦਰਸ਼ਨਾਂ ਵਾਸਤੇ ਗੁਰੂ ਸਾਹਿਬ ਦੇ ਅਤੇ ਮਤਲਬ ਕਿ ਰਹਿਣ ਲਈ ਕੋਈ ਪ੍ਰਬੰਧ ਹੈ ਲੰਗਰ ਦਾ ਅਤੇ ਇੱਕ ਗੱਲ ਹੋਰ ਵੀ ਬਾਬਾ ਜੀ ਮੈਂ ਇਹ ਪੁੱਛਣਾ ਚਾਹੁੰਦੀ ਸੀ ਕਿ ਇਸ ਟਾਹਲੀ ਸਾਹਿਬ ਗੁਰਦੁਆਰਾ ਜੀ ਕਦੋਂ ਮਤਲਬ ਕਿ ਮੇਲਾ ਕਦੋਂ ਲੱਗਦਾ ਇੱਥੇ ਜੀ ਜੀ ਪ੍ਰਧਾਨ ਸਾਹਿਬ ਜੀ ਇੱਕ ਗੱਲ ਹੋਰ ਮੈਂ ਪੁੱਛਣੀ ਚਾਹੁੰਦੀ ਸੀ ਕਿ ਇੱਥੇ ਆਉਣ ਵਾਸਤੇ ਜਿੱਦਾਂ ਸਾਧਨ ਮਤਲਬ ਲੋਕਲ ਜਿੱਦਾਂ ਆਉਣ ਜਿੱਦਾਂ ਆਟੋ ਵਗੈਰਾ ਕੁਛ ਸਾਧਨ ਹੈ ਜੀ ਠੀਕ ਠੀਕ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਸਾਹਿਬ